ਕੋਵਿਡ ਨਾਈਨਟੀਨ ਮਹਾਮਾਰੀ ਨੇ ਨਾ ਕੇਵਲ ਸਾਡੇ ਹੀ ਬਲਕਿ ਵਿਸ਼ਵ ਭਰ ਅੰਦਰ ਜਿੰਨੀਆਂ ਵੀ ਧਾਰਮਿਕ ਪਲੇਸਿਸ ਸਨ ਸੈਰ ਸਪਾਟੇ ਵਾਲੀਆਂ ਸੈਰ ਗਾਹਾਂ ਸਨ ਉੱਥੇ ਆਉਣ ਵਾਲੇ ਯਾਤਰੂਆਂ ਸੈਲਾਨੀਆਂ ਨੂੰ ਪ੍ਰਭਾਵਿਤ ਕੀਤਾ ਕਿਉਂਕਿ ਕੋਵਿਡ ਨਾਈਨਟੀਨ ਮਹਾਂਮਾਰੀ ਕਰਕੇ ਫਲਾਈਟਾਂ ਬੰਦ ਹੋ ਗਈਆਂ ਆਵਾਜਾਈ ਦੇ ਸਾਧਨ ਬੰਦ ਹੋ ਗਏ ਟਰਾਂਸਪੋਰਟ ਬੰਦ ਹੋ ਗਈ ਜਿਸ ਕਰਕੇ ਲੋਕਾਂ ਦਾ ਧਾਰਮਿਕ ਅਸਥਾਨਾਂ 'ਤੇ ਆਉਣਾ ਜਾਣਾ ਬੰਦ ਹੋ ਗਿਆ ਸਾਡੇ ਵੀ ਇਲਾਕੇ ਦੇ ਵਿੱਚ ਕਿਉਂਕਿ ਕੋਵਿਡ ਨਾਈਨਟੀਨ ਮਹਾਂਮਾਰੀ ਦੌਰਾਨ ਮੈਂ ਖਡੂਰ ਸਾਹਿਬ ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਖਡੂਰ ਸਾਹਿਬ ਜੋ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉਹ ਕਸਬਾ ਉੱਥੇ ਸਾਂ 'ਤੇ ਕੋਵਿਡ ਨਾਈਨਟੀਨ ਤੋਂ ਪਹਿਲਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਦੇ ਲਈ ਨਤਮਸਤਕ ਹੋਣ ਦੇ ਲਈ ਆਉਂਦੀਆਂ ਸਨ ਪਰ ਕੋਵਿਡ ਨਾਈਨਟੀਨ ਦੌਰਾਨ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਆਮਦ ਘਟੀ ਓਸ ਇਲਾਕੇ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਸਨ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਆਉਣ ਲੱਗੀਆਂ ਸੋ ਬੜੇ ਵੱਡੇ ਪਾ ਵੱਡੇ ਹਿੱਸੇ ਦੇ ਨਾਲ ਜਾਂ ਵੱਡੇ ਵੱਡੀ ਮਾਤਰਾ ਦੇ ਵਿੱਚ ਕੋਵਿਡ ਨਾਈਨਟੀਨ ਮਹਾਂਮਾਰੀ ਨੇ ਸਾਡੇ ਉਸ ਇਲਾਕੇ ਨੂੰ ਪ੍ਰਭਾਵਿਤ ਕੀਤਾ ਲੋਕਾਂ ਦੇ ਆਉਣ ਜਾਣ ਦੀ ਜਿਹੜੀ ਭੀੜ ਲੱਗੀ ਰਹਿੰਦੀ ਸੀਗੀ ਜਾਂ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਸਨ ਵੱਡੀ ਤਾਦਾਦ ਦੇ ਵਿੱਚ ਆਉਂਦੀਆਂ ਸਨ ਉਹ ਬਹੁਤ ਘੱਟ ਗਈ ਸੀ ਕਾਰਨ ਸੀਗਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਲੋਕਾਂ ਦੇ ਵਿੱਚ ਡਰ ਇਹ ਡਰ ਅਤੇ ਸਹਿਮ ਦੀ ਭਾਵਨਾ ਨੇ ਲੋਕਾਂ ਦੇ ਵਿੱਚ ਇਹ ਸਾਰੀ ਚੀਜ਼ ਨੂੰ ਜਿਹੜਾ ਉਹ ਪ੍ਰਚਾਰਿਆ ਜਿਸ ਕਰਕੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ ਲੱਗੇ